ਸਾਡਾ ਜਿਹੜਾ ਪਰਿਵਾਰ ਹੈ ਉਹ ਬਹੁਤ ਘੁੰਮਣਾ ਬਹੁਤ ਪਸੰਦ ਕਰਦਾ ਹੈ ਇਸ ਨਾਲ ਜਿਹੜੀ ਇਹ ਅਸੀਂ ਫੋਟੋਆਂ ਵੀ ਖਿੱਚਦੇ ਹਾਂ ਤਾਂ ਕਿ ਸਾ ਸਾਡੀਆਂ ਯਾਦਾਂ ਬਣੀਆਂ ਰਹਿਣ ਮੈਂ ਆ ਆਮ ਤੌਰ 'ਤੇ ਮੈਂ ਆਪਣੇ ਪਰਿਵਾਰ ਨਾਲ ਹੀ ਫੋਟੋ ਖਿੱਚਣੀ ਪਸੰਦ ਕਰਦੀ ਹਾਂ ਅਤੇ ਇਕੱਲੀਆਂ ਦੀ ਵੀ ਕੋਈ ਫੋਟੋ ਹੋਣਗੀਆਂ ਅਤੇ ਮੈ ਮੈਨੂੰ ਜਿਹੜਾ ਕੁਦਰਤੀ ਨਜ਼ਾਰਿਆਂ ਦੀ ਫੋਟੋ ਖਿੱਚਣਾ ਬਹੁਤ ਪਸੰਦ ਹੈ ਜਿਸ ਨਾਲ ਮੈਨੂੰ ਲੱਗਦਾ ਹੈ ਕਿ ਕੁਦਰਤ ਤੋਂ ਸੋਹਣਾ ਤਾਂ ਕੋਈ ਹੈ ਹੀ ਨਹੀਂ ਕੁਦਰਤ ਇੱਕ ਬਹੁਤ ਹੀ ਵਧੀਆ ਨਜ਼ਾਰਾ ਹੈ ਜਿਸ ਨਾਲ ਸਾਡਾ ਮਨ ਵੀ ਸਟਰੈਸ ਨਹੀਂ ਮਹਿਸੂਸ ਕਰਦਾ ਇਸ ਨਾਲ ਸਾਡਾ ਮਨੋਰੰਜਨ ਵੀ ਬਣਿਆ ਰਹਿੰਦਾ ਹੈ ਅਤੇ ਕੁਦਰਤੀ ਨਜਾਰਿਆਂ ਨੂੰ ਦੇਖਣ ਦਾ ਚਾਅ ਮੈਨੂੰ ਵੀ ਬਹੁਤ ਹੈ ਇਸ ਨਾਲ ਮੈਂ ਕੁਦ ਕੁਦਰਤ ਦੇ ਵੱਲ ਵੀ ਖਿੱਚੀ ਜਾ ਜਾਂਦੀ ਹਾਂ ਕੁਦਰਤ ਨਾਲ ਨੂੰ ਜਾਣਨ ਦਾ ਬਹੁਤ ਵਧੀਆ ਤਰੀਕਾ ਹੈ ਕਿ ਉਸ ਦੀ ਫੋਟੋ ਖਿੱਚ ਕੇ ਆਪਣੇ ਫੋਨ ਦੇ ਵਿੱਚ ਮੈਂ ਹਮੇਸ਼ਾ ਲਈ ਕੈਦ ਕਰ ਸਕਾਂ ਜਿਸ ਨਾਲ ਮੈਨੂੰ ਯਾਦ ਰਹੇਗਾ ਕਿ ਮੈਂ ਇਸ ਜਗ੍ਹਾ 'ਤੇ ਇਸ ਇਸ ਨਜ਼ਾਰੇ ਨੂੰ ਦੇਖਿਆ ਸੀ ਇਸ ਕੁਦਰਤੀ ਨਜ਼ਾਰੇ ਨੂੰ ਮੈਂ ਦੇਖਿਆ ਸੀਗਾ